ਡਰਾਇੰਗ ਕਰਦੇ ਨੂੰ ਮੈਨੂੰ ਕਾਫ਼ੀ ਸਮਾਂ ਤਾਂ ਨਹੀਂ ਹੋਇਆ ਪਰ ਜਿੱਥੇ ਤੱਕ ਮੈਂ ਆਪਣਾ ਅਨੁਭਵ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਡਰਾਇੰਗ ਮੈਂ ਅਕਸਰ ਪੈਨਸਲ ਸ਼ੇਡਿੰਗ ਦੇ ਵਿੱਚ ਕਰਦਾ ਹਾਂ ਪੈਨਸਲ ਸ਼ੇਡਿੰਗ ਵਿੱਚ ਟੈਕਸਟ ਦੀ ਲੋੜ ਨਹੀਂ ਹੁੰਦੀ ਪਰ ਮੈਂ ਟੈਕਸਟ ਸਿੱਖੇ ਜ਼ਰੂਰ ਨੇ ਤੋ ਮੈਂ ਤੁਹਾਨੂੰ ਦਸ ਦੱਸਦਾ ਗਾ ਕਿ ਜਦੋਂ ਅਸੀਂ ਡਰਾਇੰਗ ਕਰਦੇ ਹਾਂ ਉਸਦੇ ਵਿੱਚ ਫੈਬਰਿਕ ਜਾਂ ਰੁੱਖ ਦੀ ਸਕ ਵਰਗੇ ਕੁਦਰਤੀ ਤੱਤਾਂ ਨੂੰ ਦਰਸਾਉਣ ਲਈ ਅਸੀ ਕੀ ਕਰਦੇ ਹਾਂ ਜਿਵੇਂ ਕਿ ਤੁਸੀਂ ਫਰਜ਼ ਕਰੋ ਕਿ ਮੈਂ ਇੱਕ ਦਰੱਖਤ ਦਾ ਚਿੱਤਰ ਇੱਕ ਰੁੱਖ ਦਾ ਚਿੱਤਰ ਬਣਾ ਰਿਹਾ ਹਾਂ ਤਾਂ ਉਸਦੇ ਵਿੱਚ ਅਸੀਂ ਗਰਾਉਂਡ ਬਣਾਉਂਦੇ ਹਾਂ ਦਰੱਖਤ ਦੀ ਸ਼ੇਪ ਬਣਾਉਂਦੇ ਹਾਂ ਅਤੇ ਪੱਤਿਆਂ ਵਰਗੀ ਇੱਕ ਸਿਰਫ਼ ਅਸੀਂ ਇੱਕ ਖਾਖਾ ਤਿਆਰ ਕਰਦੇ ਹਾਂ ਪੈਨਸਿਲ ਨਾਲ ਹਲਕੀ ਪੈਨਸਿਲ ਦੇ ਨਾਲ ਜਿਹੜੀ ਕਿ ਬਹੁਤ ਹੀ ਬਰੀਕ ਹੁੰਦੀ ਹੈ ਟੂ ਬੀ ਐੱਚ ਦੀ ਜਾਂ ਵਨ ਬੀ ਐੱਚ ਦੀ ਇਸਨੂੰ ਬਹੁਤ ਹੀ ਬਰੀਕ ਪੈਨਸਿਲ ਮੰਨਿਆ ਜਾਂਦਾ ਹੈ ਅਤੇ ਉਸ ਨਾਲ ਅਸੀਂ ਖਾਖਾ ਤਿਆਰ ਕਰਨ ਤੋਂ ਉਪਰੰਤ ਰੰਗਾਂ ਦੇ ਨਾਲ ਉਸਨੂੰ ਹਲਕੀ ਹਲਕੀ ਸ਼ੇਡ ਕਰਦੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਵੀ ਦਰੱਖਤ ਜਿਹੜਾ ਹੁੰਦਾ ਰੰਗ ਹੁੰਦਾ ਉਹ ਹਲਕਾ ਬਰਾਊਨ ਹੁੰਦਾ ਭੂਰਾ ਹੁੰਦਾ ਤਾਂ ਭੂਰੇ ਰੰਗ ਦੀ ਵਰਤੋਂ ਕਰਦੇ ਹਾਂ ਅਤੇ ਪੱਤੇ ਅਸੀਂ ਪੈਨਸਿਲ ਨਾਲ ਨਹੀਂ ਲਾਉਂਦੇ ਪੱਤੇ ਅਸੀਂ ਬਣਾਉਂਦੇ ਹਾਂ ਹਰੇ ਕਲਰ ਦੇ ਵਿੱਚ ਹਲਕੇ ਜਿਹੇ ਹੋਰ ਕਲਰ ਮਿਕਸ ਕਰਤੇ ਜਿਵੇਂ ਚਿੱਟਾ ਕਲਰ ਮਿਕਸ ਕਰਨ ਦੇ ਨਾਲ ਅਸੀਂ ਉਸਨੂੰ ਬੁਰਸ਼ ਦੇ ਨਾਲ ਹੀ ਉਸਦਾ ਜਿਹੜਾ ਸਾਰਾ ਮੇਕਅਪ ਕਰਦੇ ਹਾਂ ਇਸ ਨਾਲ ਕੀ ਹੁੰਦਾ ਹੈ ਗਾ ਇਸ ਨਾਲ ਕਿ ਚਿੱਤਰ ਦੇ ਵਿੱਚ ਇੱਕ ਕੁਦਰਤੀ ਨਿਖਾਰ ਆਉਂਦਾ ਕਿਉਂਕਿ ਅਸੀਂ ਪੈਨਸਿਲ ਦੀ ਵਰਤੋਂ ਨਹੀਂ ਕਰਦੇ ਜ਼ਿਆਦਾ ਸਿਰਫ਼ ਰੰਗਾਂ ਦੀ ਵਰਤੋਂ ਨਾਲ ਹੀ ਅਸੀਂ ਉਹ ਚਿੱਤਰ ਨੂੰ ਨਿਖ ਨਿਖਾਰਦੇ ਹਾਂ ਠੀਕ ਹੈ ਨਾ ਕੁਦਰਤੀ ਰੰਗ ਜੇ ਅਸੀਂ ਵਰਤਣੇ ਹੋਣ ਤਾਂ ਮੈਂ ਹਰਾ ਰੰਗ ਜਿਥੋਂ ਕੁਦਰਤੀ ਸਰੋਤ ਮਿਲਦਾ ਹੈ ਜਿਵੇਂ ਕਿ ਬਹੁਤ ਚੀਜ਼ਾਂ ਨੇ ਜੋ ਆਪਾਂ ਦੇਖਦੇ ਹਾਂ ਕੁਦਰਤ ਦੇ ਵਿੱਚ ਜੋ ਆਪਾਂ ਨੂੰ ਅਲੱਗ ਅਲੱਗ ਰੰਗ ਪ੍ਰਦਾਨ ਕਰਦੀਆਂ ਨੇ ਜਿਵੇਂ ਕੀ ਜਾਮਣ ਦਾ ਰੰਗ ਹੋਇਆ ਜਿਥੋਂ ਆਪਾਂ ਨੂੰ ਜਾਮਣੀ ਰੰਗ ਪ੍ਰਾਪਤ ਹੁੰਦਾ ਹੈ ਅਤੇ ਹੋਰ ਬਹੁਤ ਸਾਰੇ ਫ਼ਲ ਨੇ ਫਰੂਟ ਨੇ ਜਿੱਥੋਂ ਆਪਾਂ ਨੂੰ ਕੁਦਰਤੀ ਰੰਗ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਅਸੀਂ ਕਰਕੇ ਕੁਦਰਤੀ ਰੰਗਾਂ ਦੀ ਵਰਤੋਂ ਕਰ ਸਕਦੇ ਹਾਂ ਪਰ ਇਸਦੇ ਵਿੱਚ ਦਿੱਕਤ ਕੀ ਹੈ ਕਿ ਇਹ ਥੋੜ੍ਹਾ ਜਿਹਾ ਜਿਹੜਾ ਮਿਠਾਸ ਛੱਡਦੇ ਹਨ ਜਿੱਥੇ ਕਰਕੇ ਵੀ ਜਿਸ ਕਰਕੇ ਵੀ ਕੀੜੀਆਂ ਜਾਂ ਹੋਰ ਜਾਨਵਰ ਕੀਟ ਆਉਂਦੇ ਹਨ